ਮੇਰੇ ਘਰ ਦੀ ਰਸੋਈ ਵਿੱਚ ਬਹੁਤ ਸਾਰੇ ਉਪਕਰਨ ਹਨ ਉਪਲਬਧ ਹਨ ਜਿਵੇਂ ਕਿ ਗੈਸ ਸਿਲੰਡਰ ਮਿਕਸੀ ਮਿਕਸਰ ਗਰਾਂਇਡਰ ਫਰਿੱਜ ਓਵਨ ਪਾਣੀ ਵਾਲਾ ਕੈਂਟ ਦਾ ਆਰ ਓ ਇੰਡਕਸ਼ਨ ਵਾਲਾ ਚੁੱਲਾ ਏਅਰ ਫਰਾਈਅਰ ਫੂਡ ਪ੍ਰੋਸੈਸਰ ਡਿਸ਼ ਵਾਸ਼ਰ ਜਿਵੇਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਅਤੇ ਪਹਿਲਾਂ ਦੋਹਰੀ ਡੰਡਾ ਹੁੰਦਾ ਸੀ ਦੋਹਰੀ ਡੰਡੇ ਦੀ ਥਾਂ ਗਰਾਂਇਡਰ ਨੇ ਲੈ ਲਈ ਹੈ ਮੇਰੇ ਮੰਮੀ ਦੋਹਰੀ ਡੰਡੇ ਦੀ ਵਰਤੋਂ ਕਰਦੇ ਹੁੰਦੇ ਸਨ ਹੁਣ ਅਸੀਂ ਗਰਾਂਇਡਰ ਦੀ ਵਰਤੋਂ ਕਰਦੇ ਹਾਂ ਪਾਣੀ ਵਾਲਾ ਆਰ ਓ ਤਾਂ ਪਹਿਲਾਂ ਕਦੇ ਦੇਖਿਆ ਹੀ ਨਹੀਂ ਸੀ ਹੁੰਦਾ ਹੁਣ ਪਾਣੀ ਵਾਲਾ ਆਰ ਓ ਲਗਭਗ ਹਰ ਘਰ ਵਿੱਚ ਹੀ ਲੱਗਾ ਦਿਸਦਾ ਹੈ ਫੂਡ ਪ੍ਰੋਸੈਸਰ ਵਿੱਚ ਆਟਾ ਗੁੰਨਣਾ ਜਾਂ ਸਬਜ਼ੀ ਕੱਟਣੀ ਬਹੁਤ ਹੀ ਸੌਖੀ ਹੋ ਗਈ ਹੈ ਅਤੇ ਬਹੁਤ ਹੀ ਜਲਦ ਅਤੇ ਘੱਟ ਸਮੇਂ ਵਿੱਚ ਇਹ ਬਿਜਲੀ ਦੇ ਉਪਕਰਨ ਦੇ ਨਾਲ ਕੰਮ ਵੀ ਬਹੁਤ ਤੇਜ਼ ਹੋ ਜਾਂਦਾ ਹੈ ਬਹੁਤ ਸਾਰੇ ਘਰਾਂ ਵਿੱਚ ਅੱਜ ਕੱਲ੍ਹ ਡਿਸ਼ ਵਾਸ਼ਰ ਵੀ ਦੇਖਣ ਨੂੰ ਮਿਲਦੇ ਹਨ ਜੋ ਕਿ ਭਾਂਡੇ ਸਾਫ ਕਰਨ ਅਤੇ ਭਾਂਡੇ ਧੋਣ ਦੇ ਕੰਮ ਆਉਂਦਾ ਹੈ ਕੋਈ ਸਬਜ਼ੀ ਗਰਮ ਕਰਨੀ ਹੋਵੇ ਤਾਂ ਮਾਈਕਰੋਵੇਵ ਓਵਨ ਵਿੱਚ ਤੀਹ ਸੈਕਿੰਡ ਲਗਾ ਕੇ ਹੀ ਫਟਾਫਟ ਹੋ ਜਾਂਦੀ ਹੈ ਜਦਕਿ ਪਹਿਲਾਂ ਗੈਸ ਸਿਲਿੰਡਰ ਜਾਂ ਫਿਰ ਚੁੱਲੇ ਉੱਤੇ ਗਰਮ ਕਰਨੀ ਪੈਂਦੀ ਸੀ ਅੱਜ ਕੱਲ੍ਹ ਚੁੱਲਾ ਵੀ ਪਿੰਡਾਂ ਵਿੱਚ ਕਿਤੇ ਕਿਤੇ ਦੇਖਣ ਨੂੰ ਹੀ ਮਿਲਦਾ ਹੈ ਅਤੇ ਚੁੱਲੇ ਦੀ ਦਾ ਥਾਂ ਸਾਰੇ ਘਰਾਂ ਵਿੱਚ ਗੈਸ ਸਿਲੰਡਰ ਆ ਗਏ ਹਨ ਚੁੱਲੇ ਦਾ ਕਾੜਨੀ ਵਾਲਾ ਦੁੱਧ ਅਤੇ ਦਹੀਂ ਲੱਸੀ ਦਾ ਤਾਂ ਸਵਾਦ ਹੀ ਕੁਝ ਹੋਰ ਹੁੰਦਾ ਹੈ ਇੱਕ ਦਿਨ ਤਾਂ ਮੇਰਾ ਗਰਾਂਇਡਰ ਵੀ ਖਰਾਬ ਹੋ ਗਿਆ ਸੀ ਅੱਜ ਕੱਲ੍ਹ ਬਹੁਤ ਸਾਰੇ ਉਪਕਰਨ ਬਿਜਲੀ ਨਾਲ ਚੱਲਣ ਵਾਲੇ ਹੁੰਦੇ ਆ ਅਤੇ ਕਦੇ ਕੋਈ ਵੀ ਉਪਕਰਨ ਖਰਾਬ ਹੋ ਜਾਏ ਤਾਂ ਕਈ ਵਰੀ ਕੰਮ ਰੁਕ ਵੀ ਜਾਂਦਾ ਹੈ ਅਤੇ ਰਿਪੇਅਰ ਦੀ ਦੁਕਾਨ 'ਤੇ ਜਾ ਕੇ ਉਸਨੂੰ ਠੀਕ ਕਰਵਾਉਣਾ ਪੈਂਦਾ ਹੈ ਰਸੋਈ ਵਿੱਚ ਕੰਮ ਕਰਨਾ ਪੁਰਾਣੇ ਸਮਿਆਂ ਨਾਲੋਂ ਬਹੁਤ ਹੀ ਬਦਲ ਗਿਆ ਅਤੇ ਬਿਜਲੀ ਦੇ ਉਪਕਰਨਾਂ ਨਾਲ ਕੰਮ ਕੁਝ ਸੌਖਾ ਵੀ ਹੋ ਗਿਆ